ਬੱਚਿਆਂ ਵਿੱਚ ਡਰਾਇੰਗ ਜਾਂ ਪੇਂਟਿੰਗ ਦੀ ਕੋਈ ਖਾਸ ਜਾਂ ਨਿਸ਼ਚਿਤ ਉਮਰ ਨਹੀਂ ਹੈ ਅਤੇ ਬੱਚਾ ਸ਼ੁਰੂ ਤੋਂ ਹੀ ਜਦੋਂ ਕਿ ਬੱਚਾ ਪੜ੍ਹਦਾ ਜਾਂ ਨਹੀਂ ਵੀ ਅਜੇ ਬੱਚਾ ਲਾਇਆ ਮੰਨ ਲਓ ਆਪਾਂ ਚਾਰ ਸਾਲ ਦਾ ਬੱਚਾ ਲਾਉਂਦੇ ਹਾਂ ਜਾਂ ਤਿੰਨ ਦਾ ਲਾਉਂਦੇ ਹਾਂ ਜੇ ਉਹ ਘੱਟ ਉਮਰ ਦਾ ਵੀ ਹੈ ਢਾਈ ਦਾ ਜਾਂ ਸਾਢੇ ਤਿੰਨ ਦਾ ਉਦੋਂ ਹੀ ਜੇ ਬੱਚਾ ਪੈਨਸਿਲ ਫੜਦਾ ਪੈਨ ਫੜਦਾ ਕਲਰ ਫੜਦਾ ਹੱਥ 'ਚ ਤਾਂ ਜੇ ਬੱਚੇ ਨੂੰ ਸ਼ੌਕ ਆ ਤਾਂ ਉਦੋਂ ਤੋਂ ਹੀ ਕਰਵਾਓ ਫੇਰ ਹੀ ਬੱਚਾ ਅੱਗੇ ਜਾ ਕੇ ਆਪਦਾ ਰੁਚੀ ਰੱਖੇਗਾ ਉਹਦੇ 'ਚ ਫੇਰ ਹੀ ਉਹ ਕਰੇਗਾ ਜੇ ਆਪਾਂ ਕਹੀਏ ਕਿ ਨਹੀਂ ਅਜੇ ਇਹਨੂੰ ਪੰਜ ਪੜ੍ਹ ਲੈਣ ਦਿਓ ਅਜੇ ਇਹਨੂੰ ਸੱਤ ਪੜ੍ਹ ਲੈਣ ਦਿਓ ਆਪਾਂ ਫੇਰ ਸਿਖਾਵਾਂਗੇ ਫੇਰ ਉਹਦੀ ਰੁਚੀ ਨਹੀਂ ਬਣਨੀ ਉਹਦੀ ਪਹਿਲਾਂ ਜੇ ਕੋਈ ਹੋਰ ਰੁਚੀ ਬਣ ਗਈ ਤਾਂ ਉਸ ਲਾਈਨ 'ਚ ਚਲਾ ਜਾਊਗਾ ਮੰਨ ਲਉ ਉਹਦੀ ਬੱਚੇ ਦੀ ਖੇਡ ਰੁਚੀ ਬਣ ਗਈ ਉਹ ਖੇਡਾਂ 'ਚ ਚਲਾ ਜਾਊਗਾ ਜੇ ਪੇਂਟਿੰਗ ਸਿਖਾਉਣੀ ਹੈ ਡਰਾਇੰਗ ਸਿਖਾਉਣੀ ਹੈ ਤਾਂ ਉਹ ਬੱਚੇ ਨੂੰ ਪਹਿਲਾਂ ਰੁਚੀ ਉਹਦੇ 'ਚ ਪੈਦਾ ਕਰੋ ਆਪ ਕਰਕੇ ਦਿਖਾਓ ਉਹਨੂੰ ਰੰਗ ਆਪ ਕਰੋ ਆਪ ਚੀਜ਼ਾਂ ਬਣਾਓ ਫੇਰ ਹੀ ਬੱਚਾ ਅੱਗੇ ਸਿੱਖੇਗਾ ਫੇਰ ਉਹ ਕਰੇਗਾ ਫੇਰ ਤੁਹਾਨੂੰ ਉਹ ਕਹੇਗਾ ਵੀ ਬੱਚਾ ਵੀ ਮੈਨੂੰ ਆਹ ਲੈ ਕੇ ਦਿਉ ਆਹ ਲੈ ਕੇ ਦਿਉ ਇਸ ਤਰ੍ਹਾਂ ਕਿ ਆਪਣਾ ਕੋਈ ਵੀ ਇਹਦੀ ਨਿਸ਼ਚਿਤ ਉਮਰ ਨਹੀਂ ਹੈ ਡਰਾਇੰਗ ਦੀ ਪੇਂਟਿੰਗ ਦੀ ਕੋਈ ਨਿਸ਼ਚਿਤ ਉਮਰ ਨਹੀਂ ਹੈ ਇਹ ਤਾਂ ਬੱਚਾ ਜਦੋਂ ਹੀ ਮੰਨ ਲਓ ਚਾਹੇ ਸ਼ੁਰੂ 'ਚ ਹੀ ਬੱਚਾ ਜਦੋਂ ਸਕੂਲ ਲਾ ਤਾ ਆਪਾਂ ਨਰਸਰੀ 'ਚ ਪਹਿਲੀ 'ਚ ਲਾ ਤਾ ਐਲ ਕੇ ਉਦੋਂ ਤੋਂ ਹੀ ਬੱਚੇ ਨੂੰ ਸ਼ੁਰੂ ਕਰ ਦਿਉ